ਪੁਰਾਣੇ ਜ਼ਮਾਨੇ ਦੇ ਲੋਕਾਂ ਦਾ ਮੰਨਣਾ ਸੀ ਕਿ ਘਰ 'ਚ ਤਾਂ ਚਲਾਉਣਾ ਤਾਂ ਘਰ ਵਿੱਚ ਖਾਣਾ ਬਣਾਉਣਾ ਔਰਤਾਂ ਦਾ ਕੰਮ ਹੈ ਅਤੇ ਘਰ ਤੋਂ ਬਾਹਰ ਜਾ ਕੇ ਜਿਹੜਾ ਕੰਮ ਵੀ ਕਰਨਾ ਉਹ ਮਰਦਾਂ ਦਾ ਕੰਮ ਹੈ ਅਤੇ ਉਹਨਾਂ ਨੂੰ ਸਿਰਫ ਰਸੋਈ ਤੱਕ ਹੀ ਸੀਮਤ ਰੱਖਿਆ ਜਾ ਸਕਦਾ ਜਾ ਰਿਹਾ ਸੀ ਜਿਸ ਕਰਕੇ ਔਰਤਾਂ ਬਾਹਰ ਦੇ ਕੰਮਾਂ ਵਿੱਚ ਨਾ ਤਾਂ ਇੱਕ ਦੇ ਦੇਖ ਸਕਦੀਆਂ ਸੀ ਅਤੇ ਨਾ ਹੀ ਉਹਨਾਂ ਵਿੱਚ ਭਾਗ ਲੈ ਸਕਦੀਆਂ ਸੀ ਪਰ ਅੱਜ ਦੇ ਟਾਈਮ ਵਿੱਚ ਇਹੋ ਜਿਹਾ ਬਿਲਕੁਲ ਵੀ ਨਹੀਂ ਹੈ ਅੱਜ ਕੱਲ੍ਹ ਔਰਤਾਂ ਸਿਰਫ ਖਾਣੇ ਤੱਕ ਸੀਮਿਤ ਨਹੀਂ ਰਹਿ ਗਈਆਂ ਬਲਕਿ ਘਰ ਤੋਂ ਬਾਹਰ ਜਾ ਕੇ ਵੀ ਕੰਮ ਕਰ ਰਹੀਆ ਹਨ ਅਤੇ ਉਹਨਾਂ ਨੂੰ ਸਿਰਫ ਘਰ 'ਚ ਖਾਣਾ ਬਣਾਉਣ ਹੀ ਨਹੀਂ ਬਲਕਿ ਆਫਿਸ ਵਿੱਚ ਜੋਬ ਕਰਨ ਤੋਂ ਲੈ ਕੇ ਬਾਹਰ ਦੇ ਸਾਰੇ ਕੰਮ ਕਰਨ ਦਾ ਵੀ ਅਧਿ ਪੂਰਾ ਅਧਿਕਾਰ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਔਰਤਾਂ ਮਰਦਾਂ ਦੇ ਮੁਕਾਬਲੇ ਬਿਲ ਜ਼ਿਆਦਾ ਕੰਮ ਕਰਦੀਆਂ ਹਨ ਉਹ ਨਾ ਕੇਵਲ ਘਰ ਸੰਭਾਲਦੀਆਂ ਬਲਕਿ ਬਾਹਰ ਜਾ ਕੇ ਵੀ ਬਹੁਤ ਕੰਮ ਕਰਦੀਆਂ ਹਨ ਉਹ ਘਰ ਵਿੱਚ ਖਾਣਾ ਬਣਾਉਣ ਵੀ ਬਣਾਉਂਦੀਆਂ ਹਨ ਅਤੇ ਬਾਹਰ ਜਾ ਕੇ ਆਫਿਸ ਵਿੱਚ ਵੀ ਕੰਮ ਕਰਦੀਆਂ ਹਨ ਉਹ ਅਤੇ ਅੱਜ ਕੱਲ੍ਹ ਦੇ ਮਰਦ ਵੀ ਉਹਨਾਂ ਦਾ ਖਾਣਾ ਖਾਣਾ ਬਣਾਉਣ ਵਿੱਚ ਕੰਮ ਹੱਥ ਵਟਾਉਂਦੇ ਹਨ ਤਾਂ ਜੋ ਦੋਨੋਂ ਬਰਾਬਰੀ ਦੇ ਨਾਲ ਘਰ ਚਲਾ ਸਕਣ ਅਤੇ ਅੱਜ ਕੱਲ੍ਹ ਦੇ ਟਾਈਮ ਵਿੱਚ ਮਰਦ ਵੀ ਖਾਣਾ ਬਣਾਉਂਦੇ ਹਨ ਅਤੇ ਸਾਡੇ ਘਰ ਵਿੱਚ ਵੀ ਸਾਡੇ ਪਾਪਾ ਅਤੇ ਭਰਾ ਜਿਹੜੇ ਅਤੇ ਮਾਂ ਮੰਮੀ ਅਤੇ ਬਾਕੀਆਂ ਦਾ ਖਚ ਘਰ ਘਰ ਦੇ ਕੰਮ ਵਿੱਚ ਹੱਥ ਵਟਾਉਂਦੇ ਹਨ ਤਾਂ ਜੋ ਉਹਨਾਂ ਨੂੰ ਘਰ ਦੇ ਕੰਮਾਂ ਦੇ ਵਿੱਚ ਵੀ ਮਦਦ ਹੋ ਸਕੇ ਅਤੇ ਉਹ ਬਾਹਰ ਦੇ ਕੰਮ ਵੀ ਕਰ ਸਕਣ ਤਾਂ ਜੋ ਉਹਨਾਂ ਨੂੰ ਜ਼ਿਆਦਾ ਥਕਾਵਟ ਵੀ ਨਾ ਹੋਵੇ ਅਤੇ ਉਹਨਾਂ ਨੂੰ ਪੂਰਾ ਪੂਰਾ ਹੌਸਲਾ ਅਤੇ ਪੂਰਾ ਪੂਰਾ ਸਪੋਰਟ ਵੀ ਮਿਲੇ ਤਾਂ ਜੋ ਉਹ ਅੱਗੇ ਵੱਧ ਕੇ ਆਪਣਾ ਨਾਮ ਕਮਾ ਸਕਣ ਅਤੇ ਕਿਉਂਕਿ ਉਹਨਾਂ ਦਾ ਸਿਰਫ ਘਰ ਤੱਕ ਹੀ ਸੀਮਿਤ ਨਾ ਰਹਿਣ ਅਤੇ ਬਾਹਰ ਜਾ ਕੇ ਵੀ ਕੰਮ ਕਰਨ